ਹਾਂਜੀ ਚਿੱਤਰਕਾਰੀ ਦੀ ਕਲਾਸ ਮੈਂ ਕਈ ਵਾਰ ਹਾਂਜੀ ਲਈ ਇਹਨਾਂ ਚਿੱਤਰਕਾਰੀ ਦਾ ਮੈਨੂੰ ਬਹੁਤ ਸ਼ੌਂਕ ਆ ਬਚਪਨ ਤੋਂ ਹੀ ਮੈਂ ਛੋਟ ਛੋਟੇ ਚਿੱਤਰ ਬਣਾਉਂਦੀ ਰਹੀ ਪਰ ਹੁਣ ਇਹਨਾਂ ਵਾ ਕਿੰਨਾ ਕੰਮ 'ਚ ਰੁਚੀ ਵੱਧ ਗਈ ਆ ਕਿ ਅਪ ਕੋਈ ਵੀ ਚਿੱਤਰ ਹੋਇਆ ਕਾਰਟੂਨ ਹੋਏ ਜਿਸ ਤਰ੍ਹਾਂ ਕੋਈ ਵੀ ਚੀਜ਼ ਨਵੀਂ ਉਹ ਨੂੰ ਆਸਾਨੀ ਨਾਲ ਬਣਾ ਲੈਂਦੇ ਹਾਂ ਅਤੇ ਇਸ ਲਈ ਮੈਂ ਤਰਨ ਤਾਰਨ ਵਰਕਸ਼ਾਪ ਵੀ ਲਈ ਸੀ ਚਿੱਤਰਕਾਰੀ ਦੇ ਵਿੱਚ ਇਹਨਾਂ ਰੁਚੀ ਹੋਣ ਦੇ ਕਰ ਕੇ ਨਾ ਮੇਰੇ ਚਿੱਤਰ ਬਣੇ ਹੋਏ ਸਾਰਿਆਂ ਨੂੰ ਬਹੁਤ ਪਸੰਦ ਵੀ ਆਉਂਦੇ ਸੀ ਅਤੇ ਇਸ ਲਈ ਇਹਨਾਂ ਵਾ ਵੀ ਬੜੇ ਵਧੀਆ ਇਹਨਾਂ ਚਿੱਤਰ ਬਣਾ ਕੇ ਪੇਸ਼ ਕੀਤੇ ਜਾਂਦੇ ਸੀ ਸਾਰੇ ਬਹੁਤ ਪਸੰਦ ਕਰਦੇ ਸੀ ਇਹਨਾਂ ਇਸ ਲਈ ਹੋਰ ਉਤਸ਼ਾਹ ਮਿਲਿਆ ਗਿਆ ਆਪਾਂ ਹੋਰ ਵਧੀਆ ਕੰਮ ਕਰ ਸਕਦੇ ਹਾਂ ਅਤੇ ਇਸ ਤੋਂ ਅਨੁਭਵ ਇਹੀ ਆ ਕਿ ਆਪਾਂ ਕਿਸੇ ਵੀ ਖੇਤਰ ਦੇ ਵਿੱਚ ਜਿਹ 'ਚ ਆਪਣੀ ਰੁਚੀ ਹੈਗੀ ਆ ਆਪਾਂ ਕੰਮ ਕਰ ਸਕਦੇ ਅਤੇ ਅੱਗੇ ਆਪਾਂ ਆ ਸਕਦੇ ਹਾਂ ਕਿਉਂਕਿ ਕੋਈ ਵੀ ਕੰਮ ਹੈ ਜਿਹੜਾ ਔਖਾ ਨਹੀਂ ਹੁੰਦਾ ਬਸ ਉਹਨੂੰ ਕਰਨ ਦਾ ਤਰੀਕਾ ਆਪਾਂ ਨੂੰ ਆਉਣਾ ਚਾਹੀਦਾ ਨਾ ਜਦੋਂ ਆਪਾਂ ਉਹਨੂੰ ਕੰਮ ਕਰਨ 'ਚ ਆਪਣੀ ਰੁਚੀ ਹੋਊਗੀ ਤਾਂ ਆਪਾਂ ਨੂੰ ਹੋਰ ਵਧੀਆ ਵਧੀਆ ਤਰੀਕੇ ਮਿਲਦੇ ਆ ਜਿਸ ਲਈ ਜਿਸ ਦੇ ਨਾਲ ਆਪਾਂ ਕੰਮ ਵਧੀਆ ਹੋਰ ਕਰ ਸਕਦੇ ਹਾਂ ਅਤੇ ਹ ਅੱਗੇ ਵੀ ਆਪਾਂ ਹੋਰ ਆਪਣੇ ਕੰਮ ਨੂੰ ਵਧਾ ਸਕਦੇ ਹਾਂ